ਰੂਪਨਗਰ ਜ਼ਿਲ੍ਹੇ ਵਿੱਚ ਲੋਕ ਬਾਹਰ ਤੋਂ ਆ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਇੱਥੇ ਕਈ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਉਨ੍ਹਾਂ ਅੱਗੇ ਸਾਹਮਣੇ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਹਾਸਿਲ ਕਰਨ ਲਈ ਬਹੁਤ ਸ਼ਿੱਦਤ ਕਰਨੀ ਪੈਂਦੀ ਹੈ ਅਤੇ ਇੱਥੇ ਦੇ ਆਰਥਿਕ ਸਮਾਜਿਕ ਵਾਤਾਵਰਨ ਰਾਜਨੀਤਿਕ ਹਾਲਾਤ ਨੂੰ ਬਿਹਤਰ ਕਰਨ ਲਈ ਸਾਨੂੰ ਸਕੂਲੀ ਸਿਸਟਮ ਸਭ ਤੋਂ ਪਹਿਲਾਂ ਬਿਹਤਰ ਕਰਨਾ ਚਾਹੀਦਾ ਹੈ ਜਿਸ ਨਾਲ ਜੋ ਨਵੀਂ ਪੀੜ੍ਹੀ ਆ ਰਹੀ ਹੈੈ ਉਹ ਆਪਣੇ ਸਮਾਜ ਵਿੱਚ ਕੁਝ ਨਾ ਕੁਝ ਸੁਧਾਰ ਲਿਆ ਸਕਣ